ਹਾਂ ਕਿਵੇਂ ਕੀ ਹਾਲ ਨੇ ਚੱਲੋ ਆ ਜਾਓ ਆ ਜਾਓ ਤੁਸੀਂ ਕਹਿ ਰਹੇ ਸੀ ਨਾ ਕੀ ਹਾਂਜੀ ਆ ਜਾਓ ਵਿਖਾ ਦਿਓ ਜੀ ਵਿਖਾ ਦਿਓ ਅੱਛਾ ਜੀ ਹਾਂਜੀ ਅਤੇ ਆਪਣਾ ਵੀਰੇ ਇਹਦਾ ਮੇਨ ਗੇਟ ਵੀ ਥੋੜ੍ਹਾ ਐਕਸਪੈਂਸਿਵ ਜਿਹਾ ਲੱਗ ਰਿਹਾ ਅਤੇ ਥੋੜ੍ਹੇ ਇਹਦੇ ਬਾਰੇ ਦੱਸ ਦਿਓ ਇਹ ਕੀ ਹਿਸਾਬ ਕਿਤਾਬ ਹੈ ਅੱਛਾ ਜੀ ਹਾਂਜੀ ਹਾਂਜੀ ਹਾਂ ਉਹ ਹਾਂ ਇਹਦਾ ਵੀ ਹੈਗਾ ਕਿ ਹਾਂ ਵੀ ਇਹ ਥੋੜ੍ਹੀ ਜਗ੍ਹਾ ਘੱਟ ਘੇਰਦਾ ਬ ਖੁੱਲ੍ਹਣ ਲੱਗਿਆਂ ਠੀਕ ਠੀਕ ਹਾਂਜੀ ਹਾਂਜੀ ਅਤੇ ਆਪਣਾ ਜਿਹੜਾ ਵੀ ਇਹ ਗਾਰਡਨ ਬਣਿਆ ਹੋਇਆ ਹੈ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿਓ ਕਿੰਨੇ ਬਾਏ ਕਿੰਨੇ ਦਾ ਏਰੀਆ ਹੈ ਅੱਛਾ ਜੀ

ਹਾਂਜੀ ਹਾਂਜੀ ਆ ਜਿਵੇਂ ਓਟੋਮੈਟਿਕ ਕਹਿ ਲਓ ਪਾਣੀ ਪੈ ਜਾਂਦਾ ਇਹਦੇ ਅੰਡਰਗਰਾਊਡ ਪਾਈਪਾਂ ਲਾਈਆਂ ਪਾਣੀ ਵਾਲੀਆਂ

ਠੀਕ ਹੈ ਠੀਕ ਹੈ ਚੱਲੋ ਆ ਜਾਓ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਫਿਰ ਹਾਂਜੀ ਠੀਕ ਹੈ ਚਲੋ ਆਪਾਂ ਆਹ ਵੀਰੇ ਕਿਹੜਾ ਡਰਾਇੰਗ ਰੂਮ ਹੈ ਜੀ ਇਹ ਆਹ ਵਾਲਾ ਅੱਛਾ ਅੱਛਾ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਲਾਈਟਿੰਗ ਵੀ ਮੈਂ ਦੇਖ ਰਿਹਾ ਕਿ ਬੜੀ ਵਧੀਆ ਕੁਆਲਿਟੀ ਦੀ ਲੱਗ ਰਹੀ ਹੈ ਹਾਂਜੀ ਅੱਛਾ ਜੀ

ਅਤੇ ਆਪਣਾ ਜਿਹੜਾ ਹੈ ਕੋਠੀ ਦੇ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਹੋਇਆ ਇਹ ਕਿੰਨੇ ਕੁ ਟਾਈਮ ਪਹਿਲਾਂ ਦਾ ਹੋਇਆ ਹੋਇਆ ਅੱਛਾ ਠੀਕ ਹੈ ਠੀਕ ਹੈ ਜੀ

ਠੀਕ ਹੈ ਠੀਕ ਆ ਜਾਓ ਆਹ ਆਪਾਂ ਅੱਗੇ ਦੇਖਦੇ ਹਾਂ ਫਿਰ ਅੱਗੇ ਦਿਖਾ ਦਿਓ ਥੋੜ੍ਹਾ ਜਲਦੀ ਸੀਗਾ ਅੱਛਾ ਜੀ ਅੱਛਾ ਜੀ ਅਤੇ ਹਾਂਜੀ ਹਾਂਜੀ ਹਾਂ ਉਹ ਵਧੀਆ ਲੱਗ ਰਿਹਾ ਟਾਈਲ ਉਹ ਹੀ ਮੈਂ ਦੇਖ ਰਿਹਾ ਕਿ ਹਾਂ ਵੀ ਮਾਰਬਲ ਵਧੀਆ ਕੁਆਲਿਟੀ ਦਾ ਲੱਗ ਰਿਹਾ ਜੀ ਅਤੇ ਆਹ ਆਪਣਾ ਕਿਚਨ ਦਾ ਵੀਰੇ ਬੜਾ ਵਧੀਆ ਕੰਮ ਹੋਇਆ ਹੋਇਆ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸੋ ਕੀ ਹਿਸਾਬ ਕਿਤਾਬ ਇਹਨਾਂ ਦਾ ਕਿੰਨੇ ਬਾਏ ਕਿੰਨੇ ਦਾ ਏਰੀਆ ਹਾਂਜੀ ਹਾਂਜੀ ਹਾਂਜੀ ਉਹ ਤਾਂ ਮਿਲੇਗਾ ਹੀ ਠੀਕ ਹੈ ਆਪਣਾ ਆਹ ਆ ਬੈਡਰੂਮ ਨੇ ਜਾ ਜਿਹੜੀ ਅੱਗੇ ਜੀ